ਹੈਲੋ ਸਰ ਗੁਰਦੀਪ ਸਿੰਘ ਮੈਂ ਪਟਿਆਲੇ ਤੋਂ ਬੋਲਦੀ ਸੀ ਸਰੋਜ ਜੀ ਬਰਨਾਲੇ ਪਾਸ ਸੁਣਿਆ ਸੀਗਾ ਜੀ ਬਹੁਤ ਘੁੰਮਣ ਵਾਸਤੇ ਇੱਥੇ ਆਉਣਾ ਸੀ ਜੀ ਕਿਹੜੀਆਂ ਕਿਹੜੀਆਂ ਜਗ੍ਹਾ ਜੀ ਇੱਥੇ ਤੁਸੀਂ ਦੱਸੋ ਸਰ ਹਾਂਜੀ ਠੀਕ ਹੈ ਸਰ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਇਹਦੇ ਇਤਿਹਾਸ ਬਾਰੇ ਵੀ ਦੱਸ ਸਕਦੇ ਹੋ ਕੋਈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ

ਅੱਛਾ ਜੀ ਠੀਕ ਹੈ ਓਕੇ ਸਰ ਚਲੋ ਜਦੋਂ ਸਾਡਾ ਪਲੈਨ ਬਣਿਆ ਅਸੀਂ ਤੁਹਾਨੂੰ ਦੱਸ ਦਵਾਂਗੇ